ਹਾਂਜੀ ਸਤਿ ਸ਼੍ਰੀ ਅਕਾਲ ਸਾਡੇ ਕਲੱਬ ਦੇ ਵਿੱਚ ਹੋਰਸ ਰਾਈਡਿੰਗ ਹੈ ਕ੍ਰਿਕਟ ਹੈ ਸ਼ੋਟ ਪੋਟ ਹੈ ਲੁਡੋ ਜੁਡੋ ਕਰਾਟੇ ਹੈ ਕ੍ਰਿਕਟ ਹੈ ਕਾਫੀ ਗੇਮਾਂ ਨੇ ਹੋਰ ਵੇਟ ਲਿਫਟਿੰਗ ਹੈ ਹਾਂਜੀ ਦੋਨੋਂ ਟਾਈਮ ਹੈਗੇ ਆ ਪੰਜ ਤੋਂ ਸੱਤ ਮੋਰਨਿੰਗ ਹੈ ਪੰਜ ਤੋਂ ਹੀ ਸੱਤ ਈਵਨਿੰਗ ਹੈ ਸਾਡੇ ਕੋਚ ਅੰਮ੍ਰਿਤਸਰ ਤੋਂ ਵੀ ਹੈਗੇ ਨੇ ਜਲੰਧਰ ਤੋਂ ਵੀ ਆਉਂਦੇ ਨੇ ਅਸੀਂ ਸਪੈਸ਼ਲ ਕੋਚ ਹਾਇਰ ਕੀਤੇ ਹੋਏ ਨੇ ਬੱਚਿਆਂ ਨੂੰ ਸਿਖਾਉਣ ਵਾਸਤੇ ਤਰਨ ਤਾਰਨ ਡਿਸਟਿਕ ਲੈਵਲ 'ਤੇ ਵੀ ਖੇਡੇ ਮਤਲਬ ਕਿ ਬੱਚਿਆਂ ਨੂੰ ਆਪਾਂ ਕਾਫੀ ਤਰਨ ਤਾਰਨ ਡਿਸਟਿਕ ਲੈਵਲ 'ਤੇ ਅਸੀਂ ਖਿਡਾਉਂਦੇ ਹਾਂ ਬੱਚਿਆਂ ਨੂੰ ਫਿਰ ਸਟੇਟ ਲੈਵਲ 'ਤੇ ਵੀ ਖੇਡਦੇ ਹੈ ਜ਼ਿਲ੍ਹਾ ਪੱਧਰੀ ਗਰਾਊਂਡ ਵੀ ਹੈਗਾ ਸਾਡੇ ਕੋਲ ਹਾਂਜੀ ਹਾਂਜੀ ਜੂਡੋ ਕਰਾਟੇ ਆ ਡਿਸਟਿਕ ਹੋਰਸ ਰਾਈਡਿੰਗ ਹੈ ਕ੍ਰਿਕਟ ਹੋਰ ਸਪੋਰਟ ਹੈ ਕਾਫੀ ਵੇਟ ਲਿਫਟਿੰਗ ਹੈ ਕਾਫੀ ਗੇਮਾਂ ਨੇ ਜਿਹੜੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਰਵਾ ਸਕਦੇ ਹੋ ਕਾਫੀ ਸਾਰੀ ਐਕਟੀਵਿਟੀਜ ਨੇ ਸਾਡੇ ਕੋਲ ਫਾਇਦਾ ਇਹ ਦਾ ਇਹ ਹੈ ਕਿ ਬੱਚੇ ਮਤਲਬ ਕਾਫੀ ਸਿਹਤਮੰਦ ਰਹਿੰਦੇ ਨੇ ਸਿਹਤ ਵਾਸਤੇ ਬਹੁਤ ਵਧੀਆ ਡਿਸਟਰਿਕ ਲੈਵਲ 'ਤੇ ਬੱਚਿਆਂ ਨੂੰ ਖਿਡਾਇਆ ਜਾਂਦਾ ਹਾਂਜੀ ਓਕੇ ਥੈਂਕ